ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਪ੍ਰਿੰਟਿੰਗ ਜੋਬ ਦੇ ਔਨਰ ਬੋਲਦੇ ਪਏ ਹੋ ਹਾਂਜੀ ਮੈਮ ਮੈਂ ਨਾ ਤੁਹਾਡੇ ਕੋਲੋਂ ਨਾ ਪੇਜ ਪ੍ਰਿੰਟ ਕਰਵਾਉਣੇ ਸੀ ਅਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਇੱਕ ਪੇਜ ਦੇ ਕਿੰਨੇ ਪੈਸੇ ਲੱਗਣਗੇ ਅੱਛਾ ਅਗਰ ਮੈਮ ਉਹਦੀ ਕੁਆਲਟੀ ਠੀਕ ਹੋਵੇਗੀ ਨਾ ਵਧੀਆ ਕੁਆਲਿਟੀ ਦੇ ਹੋਣਗੇ ਨਾ ਠੀਕ ਹੈ ਮੈਮ ਮੈਮ ਅਗਰ ਇਹੀ ਪੇਜਾਂ ਦੀ ਬਾਈਡਿੰਗ ਕਰਵਾਉਣੀ ਹੋਏ ਤਾਂ ਉਹਦਾ ਵੀ ਰੇਟ ਦੱਸ ਦਿਉ ਮੈਨੂੰ ਇੱਕ ਵਾਰੀ ਅੱਛਾ ਠੀਕ ਹੈ ਮੈਮ ਮੈਂ ਨਾ ਤੁਹਾਨੂੰ ਦੱਸ ਦਵਾਂਗੀ ਕਿ ਕਿ ਮੇਰੇ ਕੋਲ ਦਸ ਪੇਜਿਸ ਹੈ ਮੈਂ ਉਹਨਾਂ ਦੀ ਪ੍ਰਿੰਟਿੰਗ ਵੀ ਕਰਾਉਣੀ ਹੈ ਅਤੇ ਬਾਈਡਿੰਗ ਵੀ ਕਰਾਉਣੀ ਹੈ ਮੈਂ ਤੁਹਾਨੂੰ ਕੋਲ ਕਰਕੇ ਦੱਸ ਦਵਾਂਗੀ ਇਹਦੇ ਬਾਰੇ ਹਾਂਜੀ ਓਕੇ